ਹਾਂਜੀ ਮੈਨੂੰ ਲਿਖਣ ਦਾ ਬਹੁਤ ਸ਼ੌਕ ਹੈ ਖ਼ਾਸ ਤੌਰ 'ਤੇ ਰਿਸਰਚ ਆਰਟੀਕਲ ਵਗੈਰਾ ਦਾ ਰਿਸਰਚ ਆਰਟੀਕਲ ਲਿਖਣ ਲਈ ਸ਼ਾਂਤ ਮਾਹੌਲ ਚਾਹੀਦਾ ਰਿਸਰਚ ਆਰਟੀਕਲ ਲਿਖਣ ਲਈ ਮਟੀਰੀਅਲ ਪੂਰਾ ਹੋਣਾ ਚਾਹੀਦਾ ਰਿਸਰਚ ਆਰਟੀਕਲ ਲਿਖਣ ਲਈ ਸਮਾਂ ਜਿਹੜਾ ਹੈ ਉਹ ਖੁੱਲ੍ਹਾ ਵੀ ਚਾਹੀਦਾ ਲੰਬਾ ਸਮਾਂ ਚਾਹੀਦਾ ਉਹਦੇ ਲਈ ਅਧਿਐਨ ਵੀ ਬਹੁਤ ਹੋਣਾ ਚਾਹੀਦਾ ਇਸ ਲਈ ਜਦੋਂ ਅਧਿਐਨ ਨਹੀਂ ਹੋਊਗਾ ਤਾਂ ਅਸੀਂ ਰਿਸਰਚ ਆਰਟੀਕਲ ਨਹੀਂ ਲਿਖ ਸਕਦੇ ਰਿਸਰਚ ਆਰਟੀਕਲ ਲਿਖਣ ਲਈ ਸਾਨੂੰ ਪਹਿਲਾਂ ਇੱਕ ਟੌਪਿਕ ਸੋਚਣਾ ਪੈਂਦਾ ਉਸ ਟੌਪਿਕ ਦੇ ਆਧਾਰ 'ਤੇ ਸਾਨੂੰ ਮਟੀਰੀਅਲ ਇਕੱਠਾ ਕਰਨਾ ਪੈਂਦਾ ਅਤੇ ਮਟੀਰੀਅਲ ਇਕੱਠਾ ਕਰਕੇ ਫਿਰ ਅਸੀਂ ਬ ਉਹਨੂੰ ਅਧਿਐਨ ਕਰਦੇ ਹਾਂ ਅਧਿਐਨ ਕਰਨ ਤੋਂ ਬਾਅਦ ਫਿਰ ਅਸੀਂ ਆਪਣੇ ਆਪ ਆਪਣੇ ਵਿਊਜ਼ ਉਸ ਰਿਸਰਚ ਆਰਟੀਕਲ ਦੇ ਵਿੱਚ ਲਿਖਦੇ ਹਾਂ ਇਹਦੇ ਲਈ ਸਾਨੂੰ ਸ਼ਾਂਤ ਮਾਹੌਲ ਦੀ ਜ਼ਰੂਰਤ ਹੁੰਦੀ ਹੈ ਖੁੱਲ੍ਹੇ ਸਮੇਂ ਦੀ ਜ਼ਰੂਰਤ ਹੁੰਦੀ ਹੈ ਜਿਹੜਾ ਕਿ ਅੱਜ ਦੇ ਸਮੇਂ ਵਿੱਚ ਬਹੁਤ ਘੱਟ ਮਿਲਦਾ ਹੈ ਪਰ ਅਸੀਂ ਫਿਰ ਵੀ ਲਿਖਣ ਦੀ ਕੋਸ਼ਿਸ਼ ਕਰਦੇ ਹਾਂ ਜਿਹਦੇ ਵਿੱਚ ਕਈ ਵਾਰ ਅਸੀਂ ਸਫ਼ਲ ਹੁੰਦੇ ਹਾਂ ਅਤੇ ਜ਼ਿਆਦਾਤਰ ਅਸੀਂ ਅਸਫ਼ਲ ਵੀ ਹੋ ਜਾਂਦੇ ਹਾਂ ਪਰ ਅਸੀਂ ਲਗਾਤਾਰ ਆਪਣਾ ਕੰਮ ਹੈ ਜਿਹੜਾ ਉਹ ਕਰਦੇ ਰਹਿੰਦੇ ਹਾਂ ਤਾਂ ਕਿ ਜਿੰਨਾ ਹੋ ਸਕੇ ਕੰਮ ਸਹੀ ਤਰੀਕੇ ਦੇ ਨਾਲ ਕੀਤਾ ਜਾ ਸਕੇ